ਲੋਕ ਲਾੜੀ ਨੂੰ ਗਹਿਣਾ ਗੱਟਾ ਫਰਨੀਚਰ ਕੱਪੜੇ ਲਤਾ ਭਾਂਡੇ ਪੇਟੀਆਂ ਬਿਸਤਰੇ ਰਸੋਈ ਦਾ ਸਮਾਨ ਕਈ ਵਸਤੂਆਂ ਦਿੰਦੇ ਹਨ ਪਰ ਲਾੜੀ ਨੇ ਨਵੇਂ ਸਿਰੇ ਤੋਂ ਘਰ ਨੂੰ ਵਸਾਉਣਾ ਹੈ ਜੇਕਰ ਤਾਂ ਇਹ ਵਸਤੂਆਂ ਦਾਇਰੇ ਦੇ ਵਿੱਚ ਰਹਿ ਕੇ ਦਿੱਤੀ ਜਾ ਤਾਂ ਉਹ ਦਾਜ ਨਹੀਂ ਹੈ ਉਹ ਪਰਿਵਾਰ ਵੱਲੋਂ ਪਿਆਰ ਅਤੇ ਤੋਹਫ਼ਾ ਹੈ ਪਰ ਜਦੋਂ ਇਹ ਚੀਜ਼ਾਂ ਮੰਗੀਆਂ ਜਾਂਦੀਆਂ ਹਨ ਤਾਂ ਇਹ ਦਾਜ ਦਾ ਰੂਪ ਬਣ ਜਾਂਦੀ ਹੈ ਜਦੋਂ ਇੱਕ ਗਰੀਬ ਲਈ ਬਹੁਤ ਔਖਾ ਹੈ ਲੋਕ ਆਪਣੀ ਖੁਸ਼ੀਆਂ ਨੂੰ ਮਾਰ ਕੇ ਕੁੜੀਆਂ ਨੂੰ ਵਿਆਜ 'ਤੇ ਪੈਸੇ ਚੁੱਕ ਕੇ ਕੁੜੀਆਂ ਲਈ ਅਤੇ ਉਹਨਾਂ ਦੇ ਪਰਿਵਾਰ ਲਈ ਗਹਿਣਾ ਗੱਟਾ ਕੈਸ਼ ਦਿੰਦੇ ਹਨ ਜੋ ਵਿਆਹ ਪਹਿਲੇ ਸਾਦੇ ਤਰੀਕੇ ਨਾਲ ਹੁੰਦਾ ਸੀ ਉਹ ਹੁਣ ਮਹਿੰਗੇ ਪੈਲਸਾਂ ਅਤੇ ਹੋਟਲਾ ਵਿੱਚ ਕੀਤੇ ਜਾਂਦੇ ਹਨ ਇਹ ਮਾਂ ਬਾਪ 'ਤੇ ਬੋਝ ਦਾ ਕਾਰਨ ਬਣਦਾ ਹੈ ਲੋਕ ਵਿੱਚ ਦੇਖਾ ਦਿਖਾਈ ਪੈਸਾ ਖਰਚਣ ਦੀ ਅਤੇ ਦਿਖਾਵੇ ਦੀ ਆਦਤ ਬਣ ਗਈ ਹੈ